ਸਾਡੇ ਇਲਾਕੇ ਵਿੱਚ ਸੜਕਾਂ ਦਾ ਬਹੁਤ ਮੰਦਾ ਹਾਲ ਹੈ ਆਵਾਜਾਈ ਦੇ ਸਾਧਨਾਂ ਦੀ ਸਹੂਲਤ ਵੀ ਬਹੁਤ ਘੱਟ ਹੈ ਜੋ ਵੀ ਸਾਧਨ ਹਨ ਉਹ ਵੀ ਸਮੇਂ ਸਿਰ ਨਹੀਂ ਆਉਂਦੇ ਅੱਜ ਕੱਲ੍ਹ ਪੁਲਾਂ ਦੇ ਨਿਰਮਾਣ ਕਰਕੇ ਆਵਾਜਾਈ ਦਾ ਭੀੜ ਭੜੱਕਾ ਰਹਿੰਦਾ ਹੈ ਇਹਨਾਂ ਕਾਰਨਾਂ ਕਰਕੇ ਕਈ ਵਾਰ ਅਸੀਂ ਆਪਣੇ ਕੰਮਾਂ ਤੇ ਨਹੀਂ ਪਹੁੰਚ ਪਾਉਂਦੇ ਇਹ ਇੱਕ ਬਹੁਤ ਵੱਡੀ ਸਮੱਸਿਆ ਹੈ ਸਾਡੇ ਇਲਾਕੇ ਵਿੱਚ ਪ੍ਰਸ਼ਾਸਨ ਵੱਲੋਂ ਸਹੂਲਤ ਵੀ ਦਿੱਤੀ ਹੈ ਹੈ ਪਰ ਚੁਣੌਤੀਆਂ ਜ਼ਿਆਦਾ ਹਨ